ਪੰਜਾਬ ਵਿੱਚ ਮਨਾਏ ਜਾਣ ਵਾਲੇ ਮੁੱਖ ਸੱਭਿਆਚਾਰਕ ਤਿਉਹਾਰ ਗੁਰਪੁਰਬ ਵਿਸਾਖੀ ਲੋਹੜੀ ਦੀਵਾਲੀ ਹੈ ਜੋ ਕਿ ਬਹੁਤ ਹੀ ਮਹੱਤਵਪੂਰਨ ਅਤੇ ਮਹਾਨ ਤਿਉਹਾਰ ਹਨ ਲੋਕ ਪਹਿਲਾਂ ਦੇ ਲੋਕ ਬਹੁਤ ਹੀ ਵਧੀਆ ਤਰੀਕੇ ਨਾਲ ਰਲ ਮਿਲ ਕੇ ਮਨਾਉਂਦੇ ਸਨ ਜਿਹੜੇ ਕਿਸਾਨ ਖੇ ਖੇਤੀ ਵੀ ਕਰਦੇ ਸਨ ਓਹ ਤਿਉਹਾਰ ਨੂੰ ਬਹੁਤ ਹੀ ਵਧੀਆ ਅਤੇ ਖੁਸ਼ੀ ਨਾਲ ਮਨਾਉਂਦੇ ਸਨ ਓਹ ਹਰ ਤਿਉਹਾਰ ਦਾ ਇੰਤਜ਼ਾਰ ਕਰਦੇ ਸਨ ਜਦੋਂ ਤਿਉਹਾਰ ਆਉਣ ਤੋਂ ਪਹਿਲਾਂ ਲੋਕ ਆਪਸ ਵਿੱਚ ਹੀ ਪਹਿਲੇ ਹੀ ਦਿਨਾਂ ਤੋਂ ਸ਼ੁਰੂ ਤਿਆਰੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਸਨ ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਲੋਕਾਂ ਕੋਲ ਬਹੁਤ ਹੀ ਘੱਟ ਘੱਟ ਸਮਾਂ ਹੈ ਸਾਰੇ ਲੋਕ ਆਪਣੇ ਹੀ ਕੰਮਾਂ ਕਾਰਾਂ ਦੇ ਵਿੱਚ ਰੁੱਝੇ ਰਹਿੰਦੇ ਨੇ ਜਿਸ ਕਾਰਨ ਉਹਨਾਂ ਨੂੰ ਤਿਉਹਾਰ ਮਨਾਉਣਾ ਬਹੁਤ ਹੀ ਘੱਟ ਕਰ ਦਿੱਤਾ ਹੈ ਅਤੇ ਓਹਨਾਂ ਕੋਲ ਸਮਾਂ ਘੱਟ ਹੁੰਦਾ ਹੈ ਉਹ ਆਪਸ ਵਿੱਚ ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਰਹਿੰਦੇ ਹਨ ਪਹਿਲੇ ਦੇ ਲੋਕ ਵਿਸਾਖੀ ਲੋਹੜੀ ਗੁਰਪੁਰਬ ਦੀਵਾਲੀ ਕੋਈ ਵੀ ਤਿਉਹਾਰ ਬਹੁਤ ਹੀ ਖੁਸ਼ੀ ਅਤੇ ਆਪਣੇ ਮਨ ਮਨ ਨਾਲ ਬਹੁਤ ਹੀ ਖੁਸ਼ ਹੋ ਕੇ ਮਨਾਉਂਦੇ ਸਨ ਲੋਕ ਆਪ ਆਪਸ ਵਿੱਚ ਰਾਤ ਵੇਲੇ ਇਕੱਠੇ ਹੋ ਕੇ ਸਾਰੇ ਰਲ ਮਿਲ ਕੇ ਇ ਇੱਕ ਦੂਜੇ ਨੂੰ ਮਿਠਾਈਆਂ ਆਦਿ ਦੇ ਕੇ ਖੁ ਤਿਉਹਾਰ ਮਨਾਉਂਦੇ ਸਨ ਲੋਕੀ ਸਵੇਰੇ ਗੁਰਦੁਆਰੇ ਮੰਦਰ ਮੱਥਾ ਵੀ ਟੇਕਣ ਜਾਂਦੇ ਸਨ ਅਤੇ ਬਹੁਤ ਹੀ ਵਧੀਆ ਅਤੇ ਰਲ ਮਿਲ ਕੇ ਤਿਉਹਾਰ ਮਨਾਇਆ ਕਰਦੇ ਸਨ ਪਰ ਅੱਜ ਦੇ ਸਮੇਂ ਵਿੱਚ ਲੋਕ ਕੋਲ ਸਮਾਂ ਬਹੁਤ ਘੱਟ ਹੈ ਅਤੇ ਓਹ ਤਿਉਹਾਰ ਮਨਾਉਣਾ ਬਹੁਤ ਹੀ ਘੱਟ ਕਰ ਦਿੱਤਾ ਹੈ